ਪੰਜਾਬ ਦੀ ਰਾ ਰਾਜ ਭਾਸ਼ਾ ਪੰਜਾਬੀ ਭਾਸ਼ਾ ਹੈ ਇਹ ਸਾਰੀਆਂ ਭਾਸ਼ਾਵਾਂ ਨਾਲੋਂ ਉਤਕ੍ਰਿਸ਼ਟ ਹੈ ਅਤੇ ਬਹੁਤ ਸਾਰੇ ਰਾਜਾਂ ਵਿੱਚ ਵੀ ਪੰਜਾਬੀ ਬੋਲੀ ਜਾਂਦੀ ਹੈ ਪਰ ਸਮੇਂ ਦੇ ਬਦਲਣ ਨਾਲ ਪੰਜਾਬੀ ਭਾਸ਼ਾ ਕਾਫੀ ਪ੍ਰਭਾਵਿਤ ਹੋਈ ਹੈ ਅਤੇ ਕਈ ਭਾਸ਼ਾਵਾਂ ਨੇ ਜਿਵੇਂ ਕਿ ਹਿੰਦੀ ਅਤੇ ਇੰਗਲਿਸ਼ ਅੰਗਰੇਜ਼ੀ ਭਾਸ਼ਾ ਨੇ ਪੰਜਾਬੀ ਭਾਸ਼ਾ ਨੂੰ ਪ੍ਰਭਾਵਿਤ ਕੀਤਾ ਹੈ ਉਹਦੇ ਵਿੱਚ ਇਸਦਾ ਕਾਰਨ ਇਹ ਹੈ ਕਿ ਸਮਾਂ ਹੁਣ ਬਦਲੋ ਬਦਲ ਗਿਆ ਹੈ ਅਤੇ ਜਿਵੇਂ ਜਿਵੇਂ ਭਾਸ਼ਾ ਵਿੱਚ ਸ ਵਿਦਿਆਰਥੀ ਵੱਡੀਆਂ ਵੱਡੀਆਂ ਕਲਾਸਾਂ ਵਿੱਚ ਪੜ੍ਹਦੇ ਹਨ ਤਿਵੇਂ ਤਿਵੇਂ ਅੰਗਰੇਜ਼ੀ ਭਾਸ਼ਾ ਨੇ ਅਤੇ ਹਿੰਦੀ ਭਾਸ਼ਾ ਦੇ ਵਿੱਚ ਕਾਫੀ ਸ ਸੰਬੰਧਿਤ ਕਾਫੀ ਵਿਸ਼ੇ ਆਏ ਹਨ ਜਿਸ ਨਾਲ ਕਿ ਹੁਣ ਪੰਜਾਬੀ ਲੋਕ ਇੰਗਲਿਸ਼ ਇੰਗਲਿਸ਼ ਜਾਂ ਹਿੰਦੀ ਵਿੱਚ ਗੱਲ ਕਰਨ ਨੂੰ ਵਧੀਆ ਸਮਝਦੇ ਹਨ ਇਸ ਕਾਰਨ ਪੰਜਾਬੀ ਭਾਸ਼ਾ ਪ੍ਰਭਾਵਿਤ ਹੋਈ ਹੈ